ਤੁਸੀਂ ਗੋਇਲ ਏਜੰ ਟੈਕਸੀਜ ਤੋਂ ਬੋਲਦੇ ਹੋ ਅਸੀਂ ਤੁਹਾਡੇ ਤੋਂ ਮਾਨਸਾ ਤੋਂ ਅਸੀਂ ਅੰਮ੍ਰਿਤ ਜਾਣ ਵਾਸਤੇ ਅੰਮ੍ਰਿਤਸਰ ਜਾਣ ਵਾਸਤੇ ਅਸੀਂ ਟੈਕਸੀ ਬੁੱਕ ਕਰਵਾਈ ਸੀ ਮੈਂ ਤੁਹਾਡਾ ਬਹੁਤ ਪੁਰਾਣਾ ਕਸਟਮਰ ਬੋਲ ਰਹੀ ਆਂ ਕਿਉਂਕਿ ਅਸੀਂ ਜਦੋਂ ਵੀ ਕਿੱਥੇ ਜਾਂਦੇ ਆ ਘੁੰਮਣ ਵਾਸਤੇ ਅਸੀਂ ਤੁਹਾਡੇ ਤੋਂ ਹੀ ਟੈਕਸੀ ਬੁੱਕ ਕਰਵਾਉਦੇ ਆਂ ਹੁਣ ਦੱਸੋ ਤੁਸੀਂ ਵੀ ਅਸੀਂ ਅੰਮ੍ਰਿਤਸਰ ਜਾਣਾ ਘੁੰਮਣ ਵਾਸਤੇ ਤੁਹਾਨੂੰ ਵੀ ਪਤਾ ਵੀ ਚਾਰ ਪੰਜ ਘੰਟੇ ਉੱਥੇ ਲੱਗਦੇ ਆ ਠੀਕ ਹੈ ਜਾਣ ਵਾਸਤੇ ਹੁਣ ਤੁਹਾਡਾ ਡਰਾਈਵਰ ਨੂੰ ਪੁੱਛ ਕੇ ਦੱਸੋ ਵੀ ਸਾਨੂੰ ਵੀ ਕਿੰਨੇ ਸਾਡੇ ਕੋਲੇ ਕਿੰਨਾ ਕੁ ਟਾਈਮ ਤੀਕਰ ਪਹੁੰਚ ਜਾਏਗਾ ਕਿਉਂਕਿ ਪੁੱਲ ਬਣ ਰਿਹਾ ਉੱਥੇ ਪੁੱਲ ਤੋਂ ਨਹੀਂ ਆਏਗਾ ਸਿੱਧਾ ਉਹ ਵੀ ਪਿੰਡਾਂ ਵਿੱਚੋਂ ਦੀ ਹੋ ਕੇ ਆਏਗਾ ਫਿਰ ਤੁਹਾਨੂੰ ਵੀ ਪਤਾ ਪਿੰਡਾਂ ਵਿੱਚੋਂ ਦੀ ਹੋਣ ਕਰਕੇ ਟਾਈਮ ਕਿੰਨਾ ਲੱਗ ਜਾਏਗਾ ਉਹਨੂੰ ਪੁੱਛ ਕੇ ਦੱਸੋ ਕਿਰਪਾ ਕਰਕੇ ਵੀ ਉਹ ਸਾਡੇ ਕੋਲ ਕਿਸ ਟਾਈਮ ਤੀਕਰ ਪਹੁੰਚੇਗਾ ਕਿਉਂਕਿ ਅਸੀਂ ਸ਼ਾਮ ਨੂੰ ਘਰੇ ਵਾਪਿਸ ਵੀ ਆਉਣਾ ਤੁਹਾਨੂੰ ਵੀ ਪਤਾ ਵੀ ਚਾਰ ਪੰਜ ਘੰਟੇ ਤਾਂ ਜਾਣ ਦੇ ਲੱਗਦੇ ਚਾਰ ਪੰਜ ਘੰਟੇ ਆਣ ਦੇ ਲੱਗਦੇ ਆ ਹੁਣ ਤੁਸੀਂ ਉਹਨੂੰ ਪੁੱਛੋ ਵੀ ਸਾਡੇ ਕੋਲ ਕ ਕਦੋਂ ਤੀਕਰ ਪਹੁੰਚੇਗਾ ਕਿਉਂਕਿ ਅਸੀਂ ਉੱਥੇ ਜਾ ਕੇ ਵਾਪਸ ਘਰੇ ਵਾਪਸ ਵੀ ਆਉਣਾ ਹੈ